ਹੈਲੋ ਹਾਂਜੀ ਮੈਂ ਸਟੂਡੈਂਟ ਹਾਂ ਕਾਲਜ ਜਾਣਾ ਜਾਂਦੀ ਹਾਂ ਤੁਸੀਂ ਸੁਣਿਆ ਕਿ ਯੋਗਾ 'ਤੇ ਜਾਂਦੇ ਹੋ ਅਤੇ ਮੈਂ ਯੋਗਾ ਦੇ ਬਾਰੇ ਥੋੜ੍ਹੀ ਜਿਹੀ ਨੋਲੇਜ ਤੁਹਾਡੇ ਕੋਲੋਂ ਲੈਣਾ ਚਾਹੁੰਦੀ ਹਾਂ ਅਤੇ ਮੈਂ ਨਾ ਜੋਗਾ ਜੁਆਇਨ ਤਾਂ ਕਰ ਨਹੀਂ ਸਕਦੀ ਅਤੇ ਓਨਲਾਈਨ ਜੁਆਇਨ ਕਰ ਸਕਦੀ ਹਾਂ ਅਤੇ ਓਨਲਾਈਨ ਦੇ ਬਾਰੇ 'ਚ ਮੈਨੂੰ ਤੁਸੀਂ ਦੱਸੋ ਕੁਛ ਵੀ ਕਿਸ ਤਰ੍ਹਾਂ ਕਰਨਾ ਚਾਹੀਦਾ

ਹਾਂਜੀ ਨਹੀਂ ਮੈਂ ਓਨਲਾਈਨ ਕਰਨਾ ਚਾਹੁੰਦੀ ਹਾਂ ਮੈਂ ਕਿਉਂਕਿ ਸਕੋਲਜ ਜਾਣਾ ਹੁੰਦਾ ਨਾ ਹਾਂਜੀ ਹਾਂਜੀ ਹਾਂਜੀ ਮੇਰੇ ਨਾ ਗੋਡੇ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦੀ ਮੈਨੂੰ ਗੋਡੇ ਦੇ ਬਾਰੇ 'ਚ ਜ਼ਿਆਦਾ ਮੁਸ਼ਕਿਲ ਆ ਰਹੀ ਹੈ ਹਾਂਜੀ ਬੀ ਪੀ ਬੀ ਪੀ ਦੇ ਬਾਰੇ ਬੀ ਪੀ ਦੇ ਬਾਰੇ 'ਚ ਵੀ ਜਾਣਦੇ ਹੋਵੋਗੇ ਤੁਸੀਂ ਅੱਛਾ ਅੱਛਾ

ਇਸ ਦਾ ਮਤਲਬ ਇਹ ਹੈ ਕਿ ਯੋਗਾ ਜੁਆਇਨ ਕਰ ਲੈਣਾ ਚਾਹੀਦਾ ਓਨਲਾਈਨ ਚਲੋ ਟਾਈਮ ਦੀ ਸੈਟਿੰਗ ਕਰਾਂਗੇ ਫਿਰ ਤੁਹਾਡੀ ਹੈਲਪ ਲੈ ਸਕਦੇ ਉਸ ਤੋਂ ਬਾਅਦ ਓਨਲਾਈਨ ਹੀ ਜੁਆਇਨ ਕਰਾਂਗੇ ਹੋਰ ਕੋਈ ਦੱਸੋ ਗੱਲ ਜਿਸ ਤੁਹਾਨੂੰ ਵੀ ਕਿਸੇ ਗੱਲ ਦਾ ਪਤਾ ਹੋਵੇ ਤਾਂ ਅੱਛਾ ਤਾੜੀਆਂ ਮਾਰਨ ਦੇ ਬਾਰੇ ਵਿੱਚ